ਕਿਸੇ ਵਿਅਕਤੀ ਨੂੰ ਜਾਂ ਕਿਸੇ ਬੱਚੇ ਨੂੰ ਇੱਕ ਸਮਾਜ ਵਿੱਚ ਇੱਕ ਚੰਗੀ ਸੇਧ ਦੇਣ ਲਈ ਅਤੇ ਉਹਨੂੰ ਸਮਾਜ ਵਿੱਚ ਇਸ ਸਮਾਜ ਵਿੱਚ ਸਮੇਂ ਦਾ ਹਾਣੀ ਬਣਨ ਦੇ ਲਈ ਸਿੱਖਿਆ ਪ੍ਰਣਾਲੀ ਦਾ ਬਹੁਤ ਯੋਗਦਾਨ ਹੈ ਅਤੇ ਅੱਜ ਕੱਲ੍ਹ ਦੇ ਸਕੂਲਾਂ ਦੇ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਮਹੱਤਤਾ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੇਂਡੂ ਖੇਤਰਾਂ ਵਿੱਚ ਅਧਿਆਪਕਾਂ ਨੂੰ ਅਤੇ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਦਰਪੇਸ਼ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਕ ਕਰਨਾ ਪੈ ਰਿਹਾ ਹੈ ਸਿੱਖਿਆ ਦੇ ਖੇਤਰ ਵਿੱਚ ਜੇਕਰ ਮੁੱਖ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਜੋ ਮੁੱਖ ਇਨਫਰਾਸਟਰਕਚਰ ਹੈ ਉਹਦੀ ਬਹੁਤ ਹੀ ਘਾਟ ਮਹਿਸੂਸ ਕੀਤੀ ਜਾਂਦੀ ਹੈ ਸੋ ਸਕੂਲਾਂ ਦੀਆਂ ਇਨਫਰਾਸਟਰਕਚਰ ਤੋਂ ਭਾਵ ਇਕੱਲੀਆਂ ਚੰਗੀਆਂ ਬਿਲਡਿੰਗਾਂ ਜਾਂ ਇਕੱਲੇ ਟੋਇਲਟ ਬਾਥਰੂਮ ਗੁਸਲਖਾਨੇ ਹੀ ਨਹੀਂ ਹਨ ਜਾਂ ਖੇਡਾਂ ਦੇ ਮੈਦਾਨ ਹੀ ਨਹੀਂ ਹਨ ਇਹਦੇ ਵਿੱਚ ਚੰਗੀਆਂ ਕੰਪਿਊਟਰ ਨਾਲ ਸੰਬੰਧਿਤ ਲੈਬੋਰਟਰੀਜ ਸਾਇੰਸ ਨਾਲ ਸੰਬੰਧਿਤ ਲੈਬੋਰਟਰੀਜ ਇੰਟਰਨੈਟ ਦਾ ਚੰਗਾ ਕਨੈਕਸ਼ਨ ਤਾਂ ਕਰਕੇ ਕਿ ਵਿਦਿਆਰਥੀ ਵੱਖ ਵੱਖ ਔਨਲਾਈਨ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੋੋਣ ਇਹ ਵੀ ਇਸ ਵਿੱਚ ਬਹੁਤ ਵਡਮੁੱਲਾ ਯੋਗਦਾਨ ਦਿੰਦਾ ਹੈ ਅਤੇ ਸਿੱਖਿਆ ਪ੍ਰਣਾਲੀ ਦੇ ਸੰਬੰਧ ਵਿੱਚ ਅਸੀਂ ਇਹੀ ਕਹਿਣਾ ਚਾਹਵਾਂਗੇ ਕਿ ਸਰਕਾਰ ਨੂੰ ਇਸ ਸੰਬੰਧ ਵਿੱਚ ਆਪਣਾ ਜੋ ਸਲਾਨਾ ਬਜਟ ਹੈ ਉਹਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ ਚੰਗੇ ਮਾਪਦੰਡ ਬਣਾਉਣੇ ਚਾਹੀਦੇ ਹਨ ਤਾਂ ਕਰਕੇ ਇੱਕ ਸੋ ਦੈਟ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਇੱਕੋ ਜਿਹਾ ਕੀਤਾ ਜਾ ਸਕੇ ਧੰਨਵਾਦ ਜੀ